ਮੌਜੂਦਾ ਪੌਦਿਆਂ ਤੋਂ ਹੋਰ ਪੌਦੇ ਪੈਦਾ ਕਰਨ ਲਈ ਸਾਡੇ ਕੋਲ ਕਾਫੀ ਤਕਨੀਕਾਂ ਨੇ ਜਿਵੇਂ ਮੇਨ ਅਸੀਂ ਗੱਲ ਕਰੀਏ ਤਾਂ ਸਾਡੇ ਕੋਲ ਪਿਓਂਦ ਦੀ ਵਿਧੀ ਹੈ ਜਿਹਦੇ 'ਚ ਅਸੀਂ ਉਹਦਾ ਕਲਮ ਕੱਟ ਕੇ ਧਰਤੀ 'ਚ ਲਾ ਦਿੰਦੇ ਹਾਂ ਅਤੇ ਉੱਥੋਂ ਸਾਡੇ ਕੋਲ ਤੁਰ ਮਤਲਵ ਜਿਹੜੀ ਹੈ ਕਿਆ ਨਵਾਂ ਪੌਦਾ ਪੈਦਾ ਹੋ ਜਾਂਦਾ ਹੈ ਇਸੇ ਤਰੀਕੇ ਨਾਲ ਜਾਂ ਕਈਆਂ ਪੌਦਿਆਂ ਦੇ ਅਸੀਂ ਬੀਜ ਇਕੱਠੇ ਕਰ ਲੈਂਦੇ ਹਾਂ ਅਤੇ ਉਹ ਜਿਹੜੇ ਕਲਮਾਂ ਲਾ ਕੇ ਜਾਂ ਜਿਹੜੇ ਇੱਦਾਂ ਦੇ ਪੌਦੇ ਹੁੰਦੇ ਨੇ ਉਹਨਾਂ ਨੂੰ ਅਸੀਂ ਗਮਲਿਆਂ 'ਚ ਲਾ ਕੇ ਆਪਣੀ ਖੇਤੀ ਦੇ ਲਈ ਫੁੱਲਾਂ ਫੁੱਲਦਾਰ ਬੂਟੇ ਪੈਦਾ ਕਰ ਸਕਦੇ ਹਾਂ ਜਾਂ ਹੋਰ ਜਿਹੜੇ ਫਲਾਂ ਵਾਲੇ ਬੂਟੇ ਪੈਦਾ ਕਰ ਸਕਦੇ ਹਾਂ